ਬਿਲਕੁਲ ਮੈਂ ਇਹੀ ਸੋਚਦਾ ਪੰਜਾਬੀ ਭਾਸ਼ਾ ਨੇ ਹੋਰ ਭਾਸ਼ਾਵਾਂ ਨੂੰ ਵਿਕਾਸ ਨੂੰ ਬਹੁਤ ਪ੍ਰਭਾਵਿਤ ਕਰਿਆ ਹੈ ਪੰਜਾਬੀ ਬਹੁਤ ਉੱਪਰ ਚਲੀ ਗਈ ਹੈ ਬਹੁਤ ਜ਼ਿਆਦਾ ਲੈਵਲ ਉੱਪਰ ਚਲਿਆ ਗਿਆ ਇਹਨਾਂ ਦਾ ਕਿਉਂਕਿ ਇਹਨਾਂ ਦੇ ਕੋਲ ਕੰਮ ਕਰਨ ਵਾਲੇ ਬੰਦੇ ਬਹੁਤ ਪੜ੍ਹੇ ਲਿਖੇ ਆ ਗਏ ਵੇ ਜਿਨ੍ਹਾਂ ਨੂੰ ਪਤਾ ਸੀ ਅਸੀਂ ਕਿਸ ਲੈਵਲ 'ਤੇ ਕਿੱਥੇ ਕੰਮ ਕਰਨਾ ਹੈ ਜਿਵੇਂ ਤੁਸੀਂ ਪੰਜਾਬੀ ਫਿਲਮਾਂ ਦੀ ਗੱਲ ਕਰੋ ਤੁਸੀਂ ਸਾਊਥ ਦੀ ਫਿਲਮ ਨਹੀਂ ਦੇਖਣ ਬੈਠੁੰਗੇ ਤੁਹਾਨੂੰ ਪੰਜਾਬੀ ਫਿਲਮ ਹੀ ਸਮਝ ਆਉਗੀ ਅਤੇ ਸਾਊਥ ਦੇ ਬੰਦੇ ਪੰਜਾਬੀ ਫਿਲਮ ਨੂੰ ਜਲਦੀ ਸਮਝ ਲੈਣਗੇ ਕਿ ਉਹਨਾਂ ਦੇ ਵਿੱਚ ਉਹ ਚੱਲ ਕੀ ਰਿਹਾ ਡਾਇਲੋਗ ਬਾਜੀ ਨੂੰ ਉਹਨਾਂ ਦੇ ਲਹਿਜ਼ੇ ਨੂੰ ਗੱਲ ਕਰਨ ਦੇ ਨੂੰ ਇਸ਼ਾਰੇ ਕਹਿ ਲਉ ਉਨ੍ਹਾਂ ਨੂੰ ਜਲਦੀ ਸਮਝ ਆਉਂਦਾ ਹੈ ਕਿ ਪੰਜਾ ਇਹ ਬੰਦਾ ਜੋ ਪੰਜਾਬੀ ਬੋਲ ਰਿਹਾ ਹੈ ਐਕਚੂਅਲ 'ਚ ਇਹ ਕੀ ਕਹਿ ਰੇ ਕਹਿ ਰਿਹਾ ਹੁਣ ਤੁਸੀਂ ਕਦੇ ਸਾਊਥ ਦੇ ਗਾਣਿਆਂ 'ਤੇ ਨੱਚਦੇ ਨਹੀਂ ਮਿਲੋਗੇ ਤੁਹਾਨੂੰ ਪੰਜਾਬੀ ਗਾਣਿਆਂ 'ਤੇ ਸਾਊਥ ਦੇ ਬੰਦੇ ਨੱਚਦੇ ਮਿਲ ਜਾਣਗੇ ਇੱਕ ਇੱਕ ਆਮ ਇੰਗਜ਼ਾਮਪਲ ਆ ਇਹ ਅਤੇ ਇਸ ਕਰਕੇ ਪੰਜਾਬੀ ਕਾਫ਼ੀ ਉੱਪਰ ਚਲੇ ਗਈ ਹੈ ਜਿਹਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਤਾ